ਮੈਨੂੰ ਸਭ ਤੋਂ ਵਧੀਆ ਵਿਸ਼ਾ ਸੈੰਸ ਲੱਗਦਾ ਹੈ ਅਤੇ ਕਿਉਂਕਿ ਇਹ ਸਾਡੀ ਜ਼ਿੰਦਗੀ ਨਾਲ ਬਹੁਤ ਹੀ ਜ਼ਿਆਦਾ ਰੀਲੇਟਡ ਹੁੰਦਾ ਹੈ ਅਤੇ ਇਸ ਵਿੱਚ ਹਰ ਗੱਲ ਬਹੁਤ ਵਧੀਆ ਲੱਗਦੀ ਹੈ ਪਰ ਉਸ ਵਿੱਚ ਵੀ ਮੈਂ ਭੌਤਿਕ ਵਿਗਿਆਨ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੰਦਾ ਹਾਂ ਕਿਉਂਕਿ ਇਹ ਮੇਰਾ ਮਨ ਭਾਉਂਦਾ ਵਿਸ਼ਾ ਹੈ ਅਤੇ ਮੈਨੂੰ ਇਸ ਦੇ ਸਵਾਲ ਕੱਢਣੇ ਬਹੁਤ ਹੀ ਜ਼ਿਆਦਾ ਪਸੰਦ ਹਨ ਜਦੋਂ ਵੀ ਮੈਂ ਇਸ ਦਾ ਕੋਈ ਸਵਾਲ ਕੱਢਦਾ ਹਾਂ ਤਾਂ ਮੈਨੂੰ ਦਿਲੋਂ ਖੁਸ਼ੀ ਮਿਲਦੀ ਹੈ ਅਜੇ ਮੇਰਾ ਸਕੂਲ ਵਿੱਚ ਸਭ ਤੋਂ ਔਖਾ ਵਿਸ਼ਾ ਮੈਨੂੰ ਮੈਥ ਲੱਗਦਾ ਹੁੰਦਾ ਸੀ ਕਿਉਂਕਿ ਉਸ ਵਿੱਚ ਕ ਕਈ ਸਵਾਲ ਅਜਿਹੇ ਹੁੰਦੇ ਹਨ ਜਿਸ ਦਾ ਮੈਨੂੰ ਸਮਝ ਨਹੀਂ ਲੱਗਦੀ ਹੁੰਦੀ ਸੀ ਅਤੇ ਉਹ ਕਿੱਦਾਂ ਕੱਢ ਕੱਢਣੇ ਹਨ ਇਸ ਕਰਕੇ ਉਹ ਮੈਨੂੰ ਕਦੇ ਵੀ ਇੰਨਾ ਵਧੀਆ ਨਹੀਂ ਲੱਗਿਆ ਅਤੇ ਮੇਰੇ ਸਕੂਲ ਦੀ ਸਭ ਤੋਂ ਖੁਸ਼ੀ ਦੀ ਯਾਦ ਇਹ ਹੈ ਕਿ ਜਦੋਂ ਅਸੀਂ ਐਨੂਅਲ ਫੰਕਸ਼ਨ ਵਿੱਚ ਮੈਂ ਅਤੇ ਮੇਰੇ ਮਿੱਤਰਾਂ ਨੇ ਉਹ ਪਾਰਟੀਸਪੇਟ ਕੀਤਾ ਸੀ ਅਤੇ ਅਸੀਂ ਉਸ ਦਿਨ ਬਹੁਤ ਹੀ ਜ਼ਿਆਦਾ ਨੱਚੇ ਟੱਪੇ ਸਨ